ਐੱਲ ਪੀ ਜੀ ਸਲੰਡਰ ਜਿਹੜਾ ਕਿ ਅੱਜ ਦੇ ਜਮਾਨੇ ਵਿੱਚ ਹਰ ਘਰ ਵਿੱਚ ਵਰਤਿਆ ਜਾਂਦਾ ਹੈ ਇਸ ਨੂੰ ਚਲਾਉਣ ਲਈ ਬਹੁਤ ਸਾਵਧਾਨੀਆਂ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਇਹ ਇੱਕ ਜਲਣਸ਼ੀਲ ਚੀਜ਼ ਹੈ ਜਿਹਦੇ ਕਰਕੇ ਇਹਦੇ ਕੋਲ ਕੋਈ ਇਹ ਭੜਕੀਲੀ ਚੀਜ਼ ਨਹੀਂ ਆਉਣੀ ਚਾਹੀਦੀ ਈਵਨ ਜਿਹੜਾ ਮੋਬਾਈਲ ਵੀ ਹੈ ਇਹ ਇਸਦੇ ਕੋਲ ਨਹੀਂ ਆਉਣਾ ਚਾਹੀਦਾ ਤਾਂ ਕਿ ਇਹਦਾ ਕੋਈ ਸਾਈਡ ਇਫੈਕਟ ਜਾਂ ਨਾ ਪੈ ਸਕੇ ਹੋਰ ਇਸ ਦੇ ਵਿੱਚ ਅੱਗ ਜਿਹੜੀ ਹੈ ਉਹ ਇਹੋ ਜਿਹੀ ਚੀਜ਼ ਹੈ ਜਿਹੜਾ ਹਰ ਵੇਲੇ ਜ਼ਰੂਰਤ ਵੀ ਮਹਿਸੂਸ ਹੁੰਦੀ ਹੈ ਔਰ ਆਪਣੇ ਕੰਟਰੋਲ 'ਚ ਰੱਖ ਕੇ ਵਰਤਣੀ ਚਾਹੀਦੀ ਹੈ ਔਰ ਇਹ ਸੋਚਣਾ ਚਾਹੀਦਾ ਹੈ ਕਿ ਇਹ ਚੀਜ਼ ਬਹੁਤ ਖ਼ਤਰਨਾਕ ਵੀ ਸਾਬਤ ਹੋ ਸਕਦੀ ਹੈ